ਗਤਕਾ ਅਭਿਆਸ ਨਾਲ ਸੰਬੰਧਿਤ ਖਾਸ ਖੁਰਾਕ ਅਤੇ ਜੀਵਨ ਸ਼ੈਲੀ ਦੀਆਂ ਸਿਫਾਰਸ਼ਾਂ ਕਈ ਤਰ੍ਹਾਂ ਦੀਆਂ ਹਨ ਜਿਵੇਂ ਕਿ ਸਰੀਸ ਸਰੀਰਕ ਸਮ ਸਮਰੱਥਾ ਵਧਾਉਣ ਲਈ ਖੁਰਾਕ ਪ੍ਰੋਟੀਨ ਭਰਪੂਰ ਭੋਜਨ ਦਾਲਾਂ ਪਨੀਰ ਦੁੱਧ ਬਦਾਮ ਅਖਰੋਟ ਮੂੰਗਫਲੀ ਸੁੱਕੇ ਮੇਵੇ ਅਤੇ ਅੰਡੇ ਊਰਜਾ ਵਧਾਉਣ ਵਾਲੇ ਖਾਣੇ ਗੁੜ ਚੌਲ ਮਕਈ ਦੀ ਰੋਟੀ ਸ਼ਕਰਕੰਦ ਅਤੇ ਕੇਲਾ ਹੱਡੀਆਂ ਅਤੇ ਮਾਸਪੇਸ਼ੀਆਂ ਪੇਸ਼ੀਆਂ ਲਈ ਦਹੀਂ ਪਨੀਰ ਤਿਲ ਅਤੇ ਹਰੀ ਪੱਤੀਦਾਰ ਸਬਜ਼ੀਆਂ ਹਾਈਡਰੇਸ਼ਨ ਲਈ ਗੰਨੇ ਦਾ ਰਸ ਨਿੰਬੂ ਪਾਣੀ ਦੁੱਧ ਅਤੇ ਹੋਰ ਤਾਜ਼ੇ ਰਸ ਮਾਨਸਿਕ ਤਨਾਵ ਅਤੇ ਗਿਆਨ ਨੂੰ ਵਧਾਉਣ ਲਈ ਯੋਗ ਅਭਿਆਸ ਅਤੇ ਧਿਆਨ ਹਰ ਰੋਜ਼ ਦਸ ਪੰਦਰ੍ਹਾਂ ਮਿੰਟ ਲਈ ਕਰਨਾ ਚਾਹੀਦਾ ਹੈ ਚਿੰਤਾ ਘਟਾਉਣ ਅਤੇ ਖਾਣ ਅਤੇ ਖਾਣੇ ਵਾਸਤੇ ਬਦਾਮ ਆ ਅਬ ਕਾਂਡੋ ਗੁੜ ਅਤੇ ਹਲਦੀ ਵਾਲਾ ਦੁੱਧ ਪੀਣਾ ਚਾਹੀਦਾ ਹੈ ਅਤੇ ਪੋ ਪੋਸ਼ਣ ਭਰਪੂਰ ਖੁਰਾਕ ਹਨ ਵਾਲਨਟਸ ਅਤੇ ਹਰੀਆਂ ਸਬਜ਼ੀਆਂ ਹਨ ਕੈਫੀਨ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ ਜ਼ਿਆਦਾ ਚਾਹ ਕਾਫੀ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ ਗਤਕਾ ਅਭਿਆਸ ਲਈ ਵਿਸ਼ੇਸ਼ ਜੀਵਨ ਸ਼ੈਲੀ ਨਿਯਮਿਤ ਵਿੱਚ ਵਿਆਮ ਰੋਜ਼ ਇੱਕ ਦੋ ਘੰਟੇ ਗਤਕਾ ਅਭਿਆਸ ਕਰਨਾ ਚਾਹੀਦਾ ਹੈ ਜਿਸ ਵਿੱਚ ਤੋਂ ਬਾਅਦ ਆਹਾਰ ਲੈਣਾ ਬਲਿਊਬੇਰੀ ਦਹੀਂ ਅਤੇ ਪ੍ਰੋਟੀਨ ਸ਼ੇਕ ਲੈਣੇ ਚਾਹੀਦੇ ਹਨ ਆਰਾਮ ਅਤੇ ਨੀਂਦ ਰੋਜ਼ ਸੱਤ ਤੋਂ ਅੱਠ ਘੰਟੇ ਨੀਂਦ ਲੈਣੀ ਚਾਹੀਦੀ ਹੈ ਮਨ ਨੂੰ ਸ਼ਾਂਤ ਰੱਖਣ ਵਾਸਤੇ ਪਾਠ ਸ਼ਬਦ ਕੀਰਤਨ ਅਤੇ ਚਿੰਤਾ ਰਹਿਤ ਜੀਵਨ ਸ਼ੈਲੀ ਦੀ ਕਰਨਾ ਚਾਹੀਦਾ ਹੈ ਧੰਨਵਾਦ